ਹਾਂਜੀ ਮੈਨੂੰ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਜਿੱਥੇ ਮੈਂ ਚਿੱਤਰ ਬਣਾਉਣ ਦਾ ਸ਼ੌਂਕ ਰੱਖਦਾ ਹਾਂ ਉੱਥੇ ਘਰ ਦੀ ਸਜਾਵਟ ਲਈ ਵੀ ਕਈ ਦੇ ਸ਼ੋ ਪੀਸ ਖ਼ਰੀਦਣ ਵੀ ਮੈਨੂੰ ਬਹੁਤ ਪਸੰਦ ਹੈ ਮੈਨੂੰ ਪੇਂਟਿੰਗ ਬਣੀ ਪੇਂਟਿੰਗ ਬਹੁਤ ਪਸੰਦ ਹਨ ਕੁਝ ਪੇਂਟਿੰਗ ਤਾਂ ਮੈਂ ਖੁਦ ਵੀ ਬਣਾਈਆਂ ਹਨ ਉਹਨਾਂ ਤੋਂ ਬਣੀ ਪੇਂਟਿੰਗ ਇੱਕ ਲੋਕ ਕਲਾ ਹੈ ਜਿਹੜੀ ਕਿ ਬਿਹਾਰ ਵਿੱਚ ਦੇ ਮਧੂ ਮਣੀ ਦਰਬੰਗਾ ਸਹਰਸਾ ਨੇਪਾਲ ਦੇ ਕੁਝ ਖੇਤਰਾਂ ਦੀ ਪ੍ਰਮੁੱਖ ਚਿੱਤਰਕਲਾ ਹੈ ਪਹਿਲਾਂ ਪਹਿਲਾ ਇਹ ਰੰਗੋਲੀ ਦਾ ਰੂਪ ਵਿੱਚ ਹੁੰਦੀ ਸੀ ਪਰ ਬਾਅਦ ਵਿੱਚ ਕੱਪੜਿਆਂ ਦੀਵਾਰਾਂ ਅਤੇ ਕਾਗਜ਼ਾਂ 'ਤੇ ਵੀ ਉਤਰ ਆਈ ਹੈ ਚਿੱਤਰ ਦੀ ਲੋਕ ਕਲਾ ਹੈ ਇਹ ਚਿੱਤਰ ਕਲਾ ਜ਼ਿਆਦਾਤਰ ਪ੍ਰਾਚੀਨ ਅਤੇ ਪ੍ਰਕਿਰਤਿਕ ਦ੍ਰਿਸ਼ਾਂ ਅਤੇ ਦੇਵਤਿਆਂ ਦੇ ਦ੍ਰਿਸ਼ਾਂ ਨਾਲ ਸੰਬੰਧਿਤ ਹੁੰਦੀ ਹੈ ਹਾਂਜੀ ਇਹ ਕਲਾ ਕਿਰਤੀਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਕਿਉਂਕਿ ਆਰਟ ਨਾਲ ਸੰਬੰਧਿਤ ਸਮਾਨ ਚਾਹੇ ਉਹ ਵੱਖ ਵੱਖ ਰੰਗ ਹੋਣ ਤਾਂ ਵਿੱਚ ਕੱਪੜਾ ਜਾਂ ਸਟੈਸ਼ਨਰੀ ਹੋਵੇ ਇਹ ਬਹੁਤ ਹੀ ਮਹਿੰਗਾ ਮਿਲਦਾ ਹੈ ਜਿਸ ਕਾਰਨ ਇਸ ਦੀ ਖਰੀਦ ਵੀ ਕਾਫੀ ਮਹਿੰਗੀ ਹੁੰਦੀ ਹੈ ਮੈਂ ਕੁਝ ਪਸੰਦੀਦਾ ਬ੍ਰਾਂਡ ਔਨਲਾਈਨ ਦੇ ਵੱਖ ਵੱਖ ਸਾਈਟਾਂ 'ਤੇ ਉਪਲਬਧ ਹਨ ਜਾਂ ਸਮੇਂ ਸਮੇਂ ਲੱਗਣ ਵਾਲੀਆਂ ਪ੍ਰਦਰਸ਼ਨੀਆਂ 'ਤੇ ਖਰੀਦ ਲੈਂਦਾ ਹਾਂ